ਹਰ ਇੱਕ ਜਿਹੜਾ ਪ੍ਰਾਂਤ ਹੈ ਉਸ ਦਾ ਸੱਭਿਆਚਾਰ ਆਪਣਾ ਆਪਣਾ ਹੁੰਦਾ ਹੈ ਲੇਕਿਨ ਸਾਡੇ ਪੰਜਾਬ ਦਾ ਸੱਭਿਆਚਾਰ ਸਾਰੇ ਸੱਭਿਆਚਾਰਾਂ ਦੇ ਨਾਲੋਂ ਇਕਦਮ ਵੱਖਰਾ ਹੀ ਹੈ ਕਿਉਂਕਿ ਇਸ ਦੇ ਵਿੱਚ ਕੀ ਹੈ ਐਸਾ ਸਾਡਾ ਜਿਹੜਾ ਸੱਭਿਆਚਾਰ ਬਣਿਆ ਹੈ ਕਿ ਹਰ ਇੱਕ ਬੰਦਾ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਰਹਿ ਹੀ ਨਹੀਂ ਸਕਦਾ ਕਿਉਂਕਿ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਆਪਣੇ ਆਪ ਹੀ ਬੰਦੇ ਦਾ ਦਿਲ ਕਰਦਾ ਹੈ ਕਿ ਅਸੀਂ ਇਸ ਸੱਭਿਆਚਾਰ ਦਾ ਹਿੱਸਾ ਬਣੀਏ ਅਤੇ ਅਸੀਂ ਇਸ ਸੱਭਿਆਚਾਰ ਨੂੰ ਜੀਏ ਸੱਭਿਆਚਾਰ ਜਿਹੜਾ ਹੁੰਦਾ ਹੈ ਉਹ ਸਾਡੇ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਨਾਲ ਜੁੜਿਆ ਹੁੰਦਾ ਹੈ ਸੱਭਿਆਚਾਰ ਸਿਰਫ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕੀ ਮਤਲਬ ਖਾ ਰਹੇ ਹਾਂ ਕੀ ਅਸੀਂ ਮਤਲਬ ਆਪਣੇ ਕੋਈ ਮਨੋਰੰਜਨ ਦੇ ਸਾਡੇ ਸਾਧਨ ਕੀ ਹਨ ਸੱਭਿਆਚਾਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਿਲ ਹਨ ਜਿਸ ਦੇ ਵਿੱਚ ਜਿਵੇਂ ਸਾਡੇ ਉੱਠਣ ਬੈਠਣ ਦਾ ਤਰੀਕਾ ਕਿਵੇਂ ਹੈ ਸਾਡੇ ਖਾਣ ਪੀਣ ਦਾ ਸਾਡੇ ਰਹਿਣ ਸਹਿਣ ਦਾ ਸਾਡੇ ਕੱਪੜੇ ਪਾਉਣ ਦਾ ਢੰਗ ਕਿਹੋ ਜਿਹਾ ਹੈ ਅਤੇ ਅਸੀਂ ਆਪਣੇ ਜਿਹੜੇ ਅ ਰੀਤੀ ਰਿਵਾਜ ਕਿਵੇਂ ਕਰਦੇ ਹਾਂ ਅਸੀਂ ਜਨਮ ਸਮੇਂ ਅਸੀਂ ਮਰਨ ਸਮੇਂ ਅਸੀਂ ਕੋਈ ਆਪਣੇ ਵਿਆਹ ਸ਼ਾਦੀਆਂ ਦੇ ਸਮੇਂ ਜੋ ਵੀ ਸਾਡੇ ਰਿਵਾਜ਼ ਹਨ ਉਹ ਸਾਰੇ ਇੱਕ ਸੱਭਿਆਚਾਰ ਦਾ ਅੰਗ ਹੁੰਦੇ ਹਨ ਅਤੇ ਪੰਜਾਬ ਦਾ ਸੱਭਿਆਚਾਰ ਵਾਕਈ ਹੀ ਬਿਲਕੁਲ ਇੱਕ ਨਿਵੇਕਲਾ ਹੀ ਹੈ ਜੋ ਕਿ ਚਾਹੇ ਤੁਸੀਂ ਫੋਰਨ ਦੇ ਵਿੱਚ ਵੀ ਚਲੇ ਜਾਓ ਵਿਦੇਸ਼ੀ ਜਿਹੜੇ ਲੋਕ ਹਨ ਉਹ ਵੀ ਸਾਡੇ ਸੱਭਿਆਚਾਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਅਤੇ ਸਾਡੇ ਜਦੋਂ ਸੱਭਿਆਚਾਰ ਦੇ ਪੰਜਾਬੀ ਸੱਭਿਆਚਾਰ ਦੇ ਲ ਗੀਤ ਚੱਲਦੇ ਹਨ ਤਾਂ ਹਰ ਇੱਕ ਦਾ ਇਹਨਾਂ 'ਤੇ ਨੱਚਣ ਨੂੰ ਦਿਲ ਕਰਦਾ ਆਪਣੇ ਆਪ ਹੀ ਉਹਨਾਂ ਦੇ ਪੈਰ ਉੱਠਦੇ ਹਨ ਅਤੇ ਇੱਕ ਜੋਸ਼ ਭਰਿਆ ਸਾਡਾ ਸੱਭਿਆਚਾਰ ਹੈ